ਹੈਲੋ ਹਾਂਜੀ ਹਾਂਜੀ ਉਹ ਠੀਕ ਹੈ

ਸਾਡੀ ਜੀ ਅੱਛਾ ਠੀਕ ਹੈ ਕੋਚਿੰਗ ਤੁਸੀਂ ਲੈਣੀ ਹੈ ਜੇ ਆਈ ਆਈ ਟੀ ਦੀ ਕੋਚਿੰਗ ਲੈਣ ਦੀ ਮੰਨ ਲਓ ਆਪਾਂ ਹੁਣ ਅਤੇ ਆਪਣੇ ਉੱਥੇ ਇੰਸਟੀਚਿਊਟ ਬੜੇ ਵਧੀਆ ਆ ਗਏ ਨੇ ਜੀ ਜਿਹੜੇ ਟੋਪ ਲੈਵਲ 'ਤੇ ਦੇਖਦੇ ਹਾਂ ਜਿਨ੍ਹਾਂ ਦੇ ਨਾ ਬੱਚੇ ਵੀ ਜਿਹੜੇ ਹੈਗੇ ਹੈ ਟੌਪ ਰੈਂਕ 'ਤੇ ਆਏ ਹੋਏ ਆ ਚੰਗੇ ਇੰਡੀਆ ਲੈਵਲ 'ਤੇ ਉਹਨਾਂ ਨੇ ਟੋਪ ਕੀਤਾ ਜੀ ਠੀਕ ਹੈ ਜੀ ਪੰਦਰਾਂ ਇੰਸਟੀਟਿਊਟ ਹੈਗਾ ਜੀ ਇਥੇ ਐਲਨ ਕੋਪਰ ਹੈਗਾ ਜੀ ਠੀਕ ਹੈ ਜੀ ਨਮੈਰੋ ਵਾਲਿਆਂ ਦਾ ਇੰਸਟੀਟਿਊਟ ਹੈਗਾ ਜੀ ਠੀਕ ਹੈ ਜੀ ਸ਼੍ਰੀਰਾਮ ਇੰਸਟੀਚਿਊਟ ਹੈਗਾ ਜੀ ਨਾਗਪਾਲਾਂ ਦਾ ਇੰਸਟੀਟਿਊਟ ਹੈਗਾ ਜੀ ਹਰਕਿਸ਼ਨ ਇੰਸਟੀਟਿਊਟ ਹੈਗਾ ਜੀ ਆਈ ਏ ਟੀ ਅਕੈਡਮੀਆਂ ਨੇ ਜੀ ਠੀਕ ਹੈ ਜੀ ਸ਼ਰਮਾ ਹੈ ਇਹਨਾਂ ਸਾਰਿਆਂ ਤੋਂ ਬੈਟਰ ਸਾਰਿਆਂ ਦੀ ਅਲੱਗ ਅਲੱਗ ਕੁਆਲਿਟੀ ਹੈ ਹਰ ਇੱਕ ਦੇ ਟੀਚਰ ਜਿਹੜੇ ਤਜਰਬੇ ਵਾਲੇ ਹੈਗੇ ਆ ਆਈ ਆਈ ਟੀ ਤੋਂ ਪੜ੍ਹੇ ਹੋਏ ਆ ਆਈ ਆਈ ਟੀ ਤੋਂ ਪੜ੍ਹ ਕੇ ਉਹਨਾਂ ਨੇ ਇੱਥੇ ਉਥੇ ਡਿਗਰੀਆਂ ਲੈ ਕੇ ਬੀ ਟੈਕ ਐਮ ਟੈਕ ਕਰਕੇ ਉੱਥੇ ਐਕਸਪੀਰੀਅੰਸ ਪੰਦਰਾਂ ਪੰਦਰਾਂ ਸਾਲਾਂ ਦਾ ਹੈਗਾ ਜੀ ਹਰ ਇੱਕ ਦੇ ਇੰਸਟੀਟਿਊਟ ਦੇ ਅਲੱਗ ਅਲੱਗ ਹੈਗੇ ਆ ਜਿਹੜਾ ਸਭ ਤੋਂ ਟੋਪ ਦਾ ਹੈਗਾ ਉਹ ਹੈਗਾ ਸ਼ਰਮਾ ਇੰਸਟੀਟਿਊਟ ਠੀਕ ਹੈ ਜੀ ਉਹਨਾਂ ਕੋਲ ਜਿੰਨੇ ਵੀ ਜਿਹੜੇ ਵੀ ਉਥੇ ਲੈਕਚਰਾਰ ਹੈਗੇ ਆ ਜੀ ਸਾਰੇ ਐਕਸਪੀਰੀਅਸ ਦਾ ਦਸ ਤੋਂ ਪੰਦਰਾਂ ਸਾਲਾ ਦੇ ਹੈਗੇ ਆ ਜੀ ਅਤੇ ਆਪ ਉਹਨਾਂ ਜਿਹੜੇ ਲੈਕਚਰਾਰ ਨੇ ਉਹ ਵੀ ਟੋਪ ਕਰਦੇ ਆ ਠੀਕ ਹੈ ਜੀ ਉਹ ਉਹਨਾਂ ਸ਼ਰਮਾ ਇੰਸਟੀਟਿਊਟ ਤੋਂ ਆਪਾਂ ਕੋਚਿੰਗ ਲੈ ਸਕਦੇ ਹਾਂ ਜੀ ਅਤੇ ਉਹਨਾਂ ਦਾ ਵਧੀਆ ਆ ਗਿਆ ਜੀ ਸਾਰਾ ਇੰਤਜ਼ਾਮ ਵਧੀਆ ਜੀ ਬਹਿਣ ਦਾ ਫਿਟਿੰਗ ਪਲੈਨ ਬਹੁਤ ਵਧੀਆ ਗਿਆ ਉੱਥੇ ਬੱਚਿਆਂ ਦਾ ਇੱਕ ਕਲਾਸ 'ਚ ਘੱਟੋ ਘੱਟ ਵੀ ਸੱਤਰ ਸੱਤਰ ਅੱਸੀ ਅੱਸੀ ਬੱਚਿਆਂ ਦਾ ਬੈਚ ਲੈਂਦੇ ਆ ਮਾਈਕ ਲੱਗੇ ਆ ਐਲ ਈ ਡੀਆਂ ਲੱਗੀਆਂ ਨੇ ਵੱਡੀਆਂ ਵੱਡੀਆਂ ਟਾਈਮਿੰਗ ਉਹਨਾਂ ਦੇ ਦਿਨ 'ਚ ਦੋ ਤਿੰਨ ਬੈਚ ਹੈਗੇ ਆ ਜੀ ਤਿੰਨ ਬੈਚ ਹੈਗੇ ਆ ਜੀ ਸਵੇਰੇ ਨੌਂ ਤੋਂ ਬਾਰਾਂ ਹੈਗਾ ਜੀ ਦੋ ਤੋਂ ਪੰਜ ਹੈਗਾ ਜੀ ਇੱਕ ਸ਼ਾਮ ਦਾ ਛੇ ਤੋਂ ਨੌਂ ਹੋ ਗਿਆ ਜੀ ਜਿਹੜਾ ਆਪਾਂ ਨੂੰ ਸੂਟਏਬਲ ਲੱਗੇ ਉਹ ਆਪਾਂ ਟਾਈਮਿੰਗ ਲੈ ਸਕਦੇ ਹਾਂ